ਸਾਡੇ ਖੇਤਰ ਵਿੱਚ ਦੋਵੇਂ ਹੀ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਆ ਬੁਣਾਈ ਦਾ ਕੰਮ ਵੀ ਕਰਦੇ ਆ ਅਤੇ ਸਿਲਾਈ ਦਾ ਕੰਮ ਵੀ ਕਰਦੇ ਆ ਜਿਹੜੀਆਂ ਔਰਤਾਂ ਵਾ ਉਹ ਹੱਥਾਂ ਦੇ ਨਾਲ ਜੋ ਹੁੰਦੀ ਆ ਫੁਲਕਾਰੀ ਉਹ ਆਪ ਕੱਢਦੀਆਂ ਉਹਦੇ ਉੱਪਰ ਸਿਲਕੀ ਜਿਹਾ ਰੇਸ਼ਮੀ ਧਾਗੇ ਨਾਲ ਜਿਹੜਾ ਵਾ ਵੱਖੋ ਵੱਖਰਾ ਡਿਜ਼ਾਇਨ ਬਣਾਉਂਦੀਆਂ ਹੈ ਉਸ ਤੋਂ ਇਲਾਵਾ ਉਹਨਾਂ ਦੇ ਵਿੱਚ ਉਹ ਸ਼ੀਸ਼ੇ ਵੀ ਲਗਾਉਂਦੀਆ ਅਤੇ ਇੱਕ ਭਾਰੀ ਜਿਹੀ ਬਹੁਤ ਹੀ ਸੁੰਦਰ ਜਿਹੜੀ ਹੈੈ ਉਹ ਫੁਲਕਾਰੀ ਤਿਆਰ ਕਰਦੀਆਂ ਹੈ ਜਿਹੜੀਆਂ ਔਰਤਾਂ ਪਿੰਡ ਦੀਆਂ ਉਹ ਵੀ ਉਹਨਾਂ ਤੋਂ ਜਿਹੜੀਆਂ ਵਾ ਉਹ ਜਿਹੜੀਆਂ ਫੁਲਕਾਰੀਆਂ ਉਹ ਖਰੀਦ ਦੀਆਂ ਹੈ ਇਸ ਤੋਂ ਇਲਾਵਾ ਉਹ ਜਿਹੜੇ ਸੂਟ ਹੁੰਦੇ ਆ ਉਹਨਾਂ ਦੇ ਉੱਪਰ ਕਢਾਈ ਕਰਦੀਆਂ ਰੇਸ਼ਮ ਦੇ ਧਾਗੇ ਨਾਲ ਉਹ ਬਹੁਤ ਹੀ ਸੋਹਣਾ ਲੱਗਦਾ ਇਸ ਤੋਂ ਇਲਾਵਾ ਉਹ ਜੋ ਹੁੰਦੇ ਆ ਪੇਂਟਸ ਹੁੰਦੇ ਆ ਉਹਨਾਂ ਦੇ ਨਾਲ ਉਸ ਜੋ ਕੱਪੜਾ ਹੈਗਾ ਵਾ ਉਹਨੂੰ ਵਧੀਆ ਇੱਕ ਡਰਾਇੰਗ ਜਿਹੀ ਕਰਕੇ ਉਹਨੂੰ ਬਹੁਤ ਹੀ ਸੋਹਣਾ ਬਣਾਉਂਦੀਆਂ ਅਤੇ ਉਹਨੂੰ ਵੇਚਦੀਆਂ ਅੱਗੇ ਅਤੇ ਇਸ ਤਰ੍ਹਾਂ ਸਿਲਾਈ ਦਾ ਕੰਮ ਬਹੁਤ ਹੀ ਵਧੀਆ ਹੁੰਦਾ ਹੈ ਬੁਣਾਈ ਦੇ ਵਿੱਚ ਉਹ ਕਰੋਸ਼ੀਏ ਅਤੇ ਸਿਲਾਈਆਂ ਦੀ ਮਦਦ ਨਾਲ ਵੱਖੋ ਵੱਖਰੇ ਤਰ੍ਹਾਂ ਦੇ ਜਿਹੜੇ ਸਵੈਟਰ ਵਾ ਉਹ ਬਣਾਉਂਦੀਆਂ ਹੈ ਅਤੇ ਜਿਹੜੇ ਲੋਕ ਉਹਨਾਂ ਤੋਂ ਇਸ ਤਰ੍ਹਾਂ ਹੀ ਸਵੈਟਰਸ ਜਿਹੜੇ ਉਹ ਖਰੀਦ ਦੇ ਆ ਮੈਂ ਸਿਰਹੈ ਇੱਕ ਵਾਰ ਜੋ ਹੈਗਾ ਸੀਗਾ ਕੱਪੜਾ ਸੀਗਾ ਉਹਦੇ ਉੱਪਰ ਸਿਲਕ ਦੇ ਧਾਗੇ ਨਾਲ ਕੀ ਸੀਗਾ ਇੱਕ ਛੋਟੀਆਂ ਮੋਟੀਆਂ ਜਿਹੜੀਆਂ ਬੂਟੀਆਂ ਬਣਾ ਕੇ ਦੇਖੀਆਂ ਸੀ ਜਾਂ ਫਿਰ ਜੋ ਮੇਰੇ ਘਰ ਦੇ ਵਿੱਚ ਮੰਮਾ ਕੰਮ ਕਰਦੇ ਸੀ ਅਤੇ ਉਹ ਜਿਹੜਾ ਮੈਂ ਸਵੈਟਰ ਦੇ ਦੋ ਚਾਰ ਥੋੜ੍ਹਾ ਜਿਹਾ ਇਹਨੂੰ ਬਣਾ ਕੇ ਦੇਖਿਆ ਸੀ ਇਸ ਤੋਂ ਇਲਾਵਾ ਮੈਂ ਕੁਝ ਖ਼ਾਸ ਜਿਹੜਾ ਵਾ ਇਹਦੇ ਵਿੱਚ ਜ਼ਿਆਦਾ ਕੰਮ ਨਹੀਂ ਕੀਤਾ ਪਰ ਸਾਡੇ ਪਿੰਡ ਵਿੱਚ ਇਹ ਜਿਹੜਾ ਵਾ ਕੰਮ ਬਹੁਤ ਹੀ ਚੱਲਦਾ ਹੈ ਔਰਤਾਂ ਜਿਹੜੀਆਂ ਵਾ ਉਹ ਸਿਲਾਈ ਅਤੇ ਬੁਣਾਈ ਦੋਵੇਂ ਕੰਮ ਜਿਹੜੇ ਵਾ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਹੱਥਾਂ ਨਾਲ ਕਰਦੀਆਂ ਹੈ